ਜੀ ਕੋਈ ਬਹੁਤ ਵੱਡਾ ਨੇੜੇ ਕਲਾ ਸਪਲਾਈ ਸਟੋਰ ਨਹੀਂ ਹੈ ਨਿਯਮਿਤ ਤੌਰ 'ਤੇ ਮੈਂ ਸਟੇਸ਼ਨਰੀ ਜੋ ਖਰੀਦਦੀ ਹਾਂ ਜਿਸ ਵਿੱਚ ਰੰਗ ਬਰੱਸ਼ ਇਸ ਤੋਂ ਇਲਾਵਾ ਕਾਪੀ ਪੈੱਨ ਕਲਮਾਂ ਕਿਤਾਬਾਂ ਹੁੰਦੀਆਂ ਨੇ ਕਲਾ ਜਾਂ ਸ਼ਿਲਪਕਾਰੀ ਦੇ ਵਿੱਚ ਮੈਂ ਕੋਈ ਸਰਵੋਤਮ ਕਲਾਕਾਰ ਨਹੀਂ ਹਾਂ ਪਰ ਹਾਂ ਮੇਰੀ ਮਨਪਸੰਦ ਕਲਾ ਹੈ ਕਦੇ ਕਦੇ ਕਾਗਜ਼ 'ਤੇ ਕੁਛ ਉਤਾਰ ਲੈਣਾ ਜਾਂ ਫਿਰ ਰੰਗਾਂ ਦੇ ਨਾਲ ਕੋਈ ਇਹੋ ਜਿਹੀ ਚੀਜ਼ ਸਜਾ ਲੈਣੀ ਜਾਂ ਕਾਗਜ਼ ਨੂੰ ਕੱਟ ਕੇ ਕੁਝ ਮਨਪਸੰਦ ਚੀਜ਼ਾਂ ਬਣਾ ਲੈਣੀਆਂ ਕਿਸੇ ਪੱਥਰ ਦੇ ਉੱਤੇ ਰੰਗ ਕਰਕੇ ਉਸਨੂੰ ਵੱਖਰੇ ਵੱਖਰੇ ਰੰਗਾਂ ਦੇ ਨਾਲ ਅਲੱਗ ਅਲੱਗ ਰੰਗਾਂ ਦੇ ਨਾਲ ਸਜਾ ਦੇਣਾ ਕੋਈ ਫੁੱਲ ਬੂਟੀਆਂ ਬਣਾ ਲੈਣੀਆਂ ਜਾਂ ਕੋਈ ਇਸ ਤਰ੍ਹਾਂ ਦਾ ਨਮੂਨਾ ਤਿਆਰ ਕਰ ਲੈਣਾ ਜਿਵੇਂ ਕੋਈ ਵਗਦੇ ਪਾਣੀ ਵਰਗੇ ਰੰਗ ਹੋਣ ਜਾਂ ਫਿਰ ਆਮ ਤੌਰ 'ਤੇ ਮੈਂ ਜੋ ਹੈ ਸੋਸ਼ਲ ਮੀਡੀਆ ਤੋਂ ਹੀ ਇਹ ਕੰਮ ਸਿੱਖਦੀ ਹਾਂ ਜਿਵੇਂ ਆਰਟ ਕਰਾਫਟ ਦੀਆਂ ਬਹੁਤ ਸਾਰੀਆਂ ਵੀਡੀਓਜ ਆਪਾਂ ਨੂੰ ਅਕਸਰ ਦੇਖਣ ਲਈ ਮਿਲ ਜਾਂਦੀਆਂ ਹਨ ਅੱਜ ਕੱਲ੍ਹ ਗੂਗਲ ਬਾਬਾ ਇੱਕ ਇਹੋ ਜਿਹੀ ਚੀਜ਼ ਹੈ ਜਿਸ ਤੋਂ ਤੁਸੀਂ ਬਹੁਤ ਕੁਛ ਸਿੱਖ ਸਕਦੇ ਹੋ ਤਾਂ ਉੱਥੋਂ ਵੇਖ ਕੇ ਮੈਂ ਕਈ ਤਰ੍ਹਾਂ ਦੀਆਂ ਕਲਾਤਮਕ ਜਿਹੜੀਆਂ ਚੀਜ਼ਾਂ ਨੇ ਜਿਹੜੀ ਕਲਾ ਹੈ ਉਸ ਦੇ ਨਾਲ ਜੁੜੀ ਹੋਈ ਹਾਂ ਅਦਰਵਾਈਜ਼ ਕੋਈ ਜਿਹੜਾ ਹੈ ਨੇੜੇ ਸਟੋਰ ਮੇਰੇ ਘਰ ਦੇ ਨੇੜੇ ਨਹੀਂ ਹੈ